ਸਾਡੇ ਪੰਜਾਬੀ ਸੱਭਿਆਚਾਰ ਦੇ ਮੁੱਖ ਤੱਤ ਸਾਡੇ ਪਹਿਰਾਵਾ ਅਤੇ ਸਾਡਾ ਖਾਣਾ ਪੀਣਾ ਅਤੇ ਸਾਡੇ ਨਾਚ ਗਾਣੇ ਆ ਜੋ ਕਿ ਬੜੇ ਸ਼ੁੱਧ ਆ ਪੰਜਾਬੀਆਂ ਦਾ ਪਹਿਰਾਵਾ ਵੀ ਬੜਾ ਸ ਸਾਦਾ ਏ ਆ ਅਤੇ ਸਾਡੇ ਜਿਹੜੇ ਖਾਣੇ ਆ ਉਹ ਬਿਲਕੁਲ ਸ਼ੁੱਧ ਆ ਜਿਵੇਂ ਕਿ ਦਹੀਂ ਲੱਸੀ ਇਹ ਚੀਜ਼ਾਂ ਸਾਡੀ ਖਾਣੇ ਪੀਣੇ ਵਿੱਚ ਪੰਜਾਬੀਆਂ ਦੇ ਵਿੱਚ ਮਸ਼ਹੂਰ ਆ ਤੇ ਉਸ ਤੋਂ ਬਾਅਦ ਸਾਡਾ ਜੋ ਪਹਿਰਾਵਾ ਏ ਆ ਉਹ ਵੀ ਬਿਲਕੁਲ ਸਿੰਪਲ ਆ ਅਤੇ ਸਾਡੇ ਨਾਚ ਗਾਣੇ ਵੀ ਬਹੁਤ ਫੁਰਤੀਲੇ ਆ ਅਤੇ ਸਾਡੇ ਨਾਚ ਗਾਣਿਆਂ ਵਿੱਚ ਲੁੱਚੜਪੁਣਾ ਨਹੀਂ ਹੈਗਾ